ਹਰ ਬਾਈਕਰ ਨੂੰ ਫਸਟ ਏਡ ਦੀਆਂ ਕੁਝ ਬੇਸਿਕ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਛੋਟੇ ਮੋਟੇ ਜਖ਼ਮ ਨੂੰ ਸਾਫ਼ ਕਰਨਾ ਔਰ ਬੈਂਡੇਜ ਕਰਨਾ ਆਉਣਾ ਚਾਹੀਦਾ ਹੈ ਹੱਡੀਆਂ ਦੇ ਫਰੈਕਚਰ ਦੀ ਪਹਿਚਾਣ ਹੋਣੀ ਚਾਹੀਦੀ ਹੈ ਔਰ ਪਤਾ ਹੋਣਾ ਚਾਹੀਦਾ ਹੈ ਕਿ ਇੰਜਡ ਹਿੱਸੇ ਨੂੰ ਸਪੋਰਟ ਕਿਵੇਂ ਦੇਈਏ ਸਾਹ ਲੈਣ ਵਿੱਚ ਤਕਲੀਫ ਜਾਂ ਜਾਣ ਵਾਲੇ ਬੰਦੇ ਦੀ ਮਦਦ ਕਰਨੀ ਆਉਣੀ ਚਾਹੀਦੀ ਹੈ ਔਰ ਦੀ ਬੇਸਿਕ ਟ੍ਰੇਨਿੰਗ ਵੀ ਆਉਣੀ ਚਾਹੀਦੀ ਹੈ ਮੈਡੀਕਲ ਦੀ ਨਾਲ ਸਬੰਧਿਤ ਬਾਈਕਰ ਕੋਲ ਇੱਕ ਫਸਟ ਏਡ ਕਿੱਟ ਹੋਣੀ ਚਾਹੀਦੀ ਹੈ ਜਿਸ ਵਿੱਚ ਬੈਂਡੇਜ ਐਟੀਸੇਪਟਿਕ ਵਾਈਪਸ ਪੇਨ ਕਿਲਰ ਮੋਟੀ ਬੈਂਡੇਜ ਟਰੈਂਗਲ ਬੈਂਡੇਜ ਸੀਜਰ ਗਲਬ ਔਰ ਐਂਟੀਸੈਪਟਿਕ ਕਰੀਮ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਇੱਕ ਬਾਈਕਰ ਕੋਲ ਜ਼ਰੂਰ ਹੋਣੀਆਂ ਚਾਹੀਦੀਆਂ ਹੈ ਜਿਸ ਨਾਲ ਉਹ ਆਪਣਾ ਐ ਐਂਮਰਜੰਸੀ ਸਿਚੁਏਸ਼ਨ ਵਿੱਚ ਕ ਮਦਦ ਆ ਸਕੇ ਅਤੇ ਉਹ ਦੂਜੇ ਬਾਈਕਰ ਦੀ ਵੀ ਸਹਾਇਤਾ ਕਰ ਸਕੇ